ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਆ ਠੀਕ ਹੈ ਜੀ ਆਪਣੇ ਉਰੇ ਕਲੱਬ 'ਚ ਐਂਈ ਕਹਿ ਲਉ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਕੁਛ ਨਹੀਂ ਸਾਰੀਆਂ ਫਸਿਲਿਟੀਜ਼ ਪ੍ਰੋਵਾਇਡ ਕਰਦੇ ਆ ਹਰ ਗੇਮ 'ਚ ਆਪਾਂ ਉਹਨਾਂ ਨੂੰ ਪਾਰਟੀਸੀਪੇਟ ਕਰਵਾਉਂਦੇ ਹਾਂ ਠੀਕ ਹੈ ਜਿਵੇਂ ਆਪਾਂ ਐਂ ਕਹਿ ਲਉ ਵੀ ਚੈੱਸ ਹੋ ਗਿਆ ਕੈਰਮ ਹੋ ਗਿਆ ਲੁੱਡੋ ਹੋ ਗਿਆ ਸਭ ਗੇਮਜ਼ ਆਪਾਂ ਖਡਵਾਉਂਦੇ ਹਾਂ ਉਹਨਾਂ ਨੂੰ ਠੀਕ ਹੈ ਕਲੱਬ 'ਚ ਹਰ ਐਕਟੀਵਿਟੀ ਹੁੰਦੀ ਹੈ ਜੀ ਉਰੇ ਬੱਚੇ ਨੂੰ ਮਤਲਬ ਕਿਸੇ ਤਰੀਕੇ ਦਾ ਕੋਈ ਵੀ ਬੋਰਿੰਗ ਕੰਮ ਨਹੀਂ ਹੈਗਾ ਆਪਣੇ ਉਰੇ ਸਾਰੇ ਬੱਚੇ ਐਂਟਰਟੇਨਮੈਂਟ ਨਾਲ ਵਧੀਆ ਇੰਜੋਏ ਕਰਦੇ ਹੈ ਨਾਲ ਨਾਲ ਉਹਨਾਂ ਨੂੰ ਵਧੀਆ ਸਿੱਖਣ ਨੂੰ ਮਿਲਦਾ ਹੈਗਾ ਠੀਕ ਹੈ ਹਾਂਜੀ ਕਿਵੇਂ ਜੀ ਕਿਵੇਂ ਹਾਂਜੀ ਹਾਂਜੀ ਬੱਚਿਆਂ ਦੀ ਸੇਫ਼ਟੀ ਪੂਰੀ ਆਪਣੇ ਸਕਿਊਰਿਟੀ ਗਾਰਡਜ਼ ਰੱਖੇ ਹੋਏ ਨੇ ਬਾਹਰ ਕ ਸਾਰੀ ਜਗ੍ਹਾ ਕੈਮਰੇਜ਼ ਲੱਗੇ ਹੋਏ ਨੇ ਬਿਨਾਂ ਟੀਚਰਜ਼ ਦੀ ਪਰਮੀਸ਼ਨ ਤੋਂ ਕੋਈ ਸਟੂਡੈਂਟ ਬਾਹਰ ਨਹੀਂ ਜਾ ਸਕਦਾ ਕੋਈ ਬੱਚਾ ਬਾਹਰ ਨਹੀਂ ਜਾ ਸਕਦਾ ਠੀਕ ਹੈ ਅਗਰ ਮੰਨ ਲਓ ਕਿਸੇ ਨੇ ਬਾਹਰ ਜਾਣਾ ਤਾਂ ਪੇਰੇਂਟਸ ਅਗਰ ਆਵੇਗਾ ਸਪੈਸ਼ਲੀ ਤਾਂ ਪਹਿਲਾਂ ਸਕਿਉਰਿਟੀ ਗਾਰਡ ਕੋਲ ਉੱਥੇ ਨਾਮ ਵਗੈਰਾ ਆਪਦਾ ਰਜਿਸਟਰ ਕਰਵਾਉਗਾ ਫਿਰ ਇਸ ਤੋਂ ਬਾਅਦ ਸਕਿਉਰਿਟੀ ਗਾਰਡ ਉਹਨਾਂ ਨੂੰ ਸਲਿੱਪ ਦਉ ਦੇਨ ਬਾਅਦ 'ਚੋਂ ਅੰਦਰ ਕਲਾਸ ਇੰਚਾਰਜ ਕੋਲ ਆਉਣਗੇ ਫਿਰ ਆਪਾਂ ਬੱਚੇ ਨੂੰ ਬਾਹਰ ਭੇਜ ਦਿਆਂਗੇ ਉਹ ਵੀ ਨਾਲ ਐਂ ਕਹਿ ਲਉ ਵੀ ਕੋਈ ਪੀਓਨ ਵਗੈਰਾ ਆਉਂਦੇ ਏਗੇ ਉਹਨਾਂ ਨਾਲ ਬਾਹਰ ਭੇਜਦੇ ਆ ਜਿੰਨਾਂ ਚਿਰ ਪੇਰੇਂਟਸ ਦੇ ਹੱਥ 'ਚ ਬੱਚਾ ਨਹੀਂ ਜਾਂਦਾ ਓਨਾਂ ਚਿਰ ਨਹੀਂ ਨਹੀਂ ਕੋਈ ਗੱਲ ਨਹੀਂ ਸਰਵਿਸ ਸਾਡੇ ਵਲੋਂ ਪੂਰੀ ਹੈ ਅਸੀਂ ਖੁਦ ਪਿੱਕ ਕਰਕੇ ਲੈ ਜਾਂਦੇ ਹੁੰਦੇ ਹਾਂ ਖੁਦ ਹੀ ਡ੍ਰੌਪ ਕਰਦੇ ਹਾਂ ਬੱਚਿਆਂ ਨੂੰ ਜਿੱਥੇ ਜਿਵੇਂ ਜਿਵੇਂ ਉਹਨਾਂ ਨੇ ਅਡਰੈੱਸ ਦਿੱਤਾ ਹੁੰਦਾ ਨਾ ਉਸ ਅਡਰੈੱਸ 'ਤੇ ਆਪਾਂ ਬੱਚੇ ਨੂੰ ਪਹੁੰਚਾਉਂਦੇ ਹਾਂ ਉਥੋਂ ਹੀ ਪਿੱਕ ਕਰਦੇ ਹਾਂ ਆਪਾਂ ਟਾਇਮਿੰਗ ਪਰ ਹੈਗੀ ਆ ਸਾਡੀ ਪਰ ਕਲਾਸ ਐਂਏ ਕਹਿ ਲਉ ਕਿ ਵੀ ਡੇਢ ਘੰਟੇ ਦੀ ਹੁੰਦੀ ਹੈਗੀ ਵੀ ਆਰਾਮ ਨਾਲ ਇੱਕ ਡੇਢ ਘੰਟੇ ਦੀ ਆਪਾਂ ਇੱਕ ਕਲਾਸ ਲਗਾਉਂਦੇ ਹਾਂ ਹਾਂਜੀ ਫੀਸ ਵੀ ਐਂ ਕਹਿ ਲਉ ਕੋਈ ਜ਼ਿਆਦਾ ਨਹੀਂ ਹੈਗੀ ਐਂਈ ਕਹਿ ਲਉ ਮਤਲਬ ਬੀ ਪਰ ਮੰਥ ਦੀ ਜੇ ਪੁੱਛਣੀ ਹੈ ਕਿ ਪੂਰੇ ਈਅਰ ਦੀ ਪੁੱਛਣੀ ਹੈ ਪਰ ਮੰਥ ਦੀ ਐਂਈ ਕਹਿ ਲਉ ਸੈਵਨ ਹੰਡਰਡ ਫੀਸ ਲਾ ਲਉ ਤੁਸੀਂ ਹਾਂਜੀ ਹਾਂਜੀ ਓ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਵੈਲਕਮ ਜੀ